ਅੱਜ ਕੱਲ੍ਹ ਦੇ ਟਾਈਮ 'ਤੇ ਖਾਣਾ ਬਣਾਉਣਾ ਕੋਈ ਜ਼ਿਆਦਾ ਮੁਸ਼ਕਿਲ ਕੰਮ ਨਹੀਂ ਰਹਿ ਗਿਆ ਸਾਨੂੰ ਗੂਗਲ ਯੂਟੀਊਬ ਬਹੁਤ ਮਦਦ ਕਰਦੇ ਆ ਅਸੀਂ ਜੋ ਵੀ ਚੀਜ਼ ਬਣਾਉਣਾ ਚਾਹੁੰਦੇ ਹਾਂ ਜਿਸ ਵੀ ਤਰ੍ਹਾਂ ਦੀ ਜਿਸ ਵੀ ਦੇਸ਼ ਦੀ ਅਸੀਂ ਕੋਈ ਵੀ ਰੈਸਪੀ ਲੱਭਣੀ ਚਾਹੀਏ ਉਹ ਤੋਂ ਲੱਭ ਕੇ ਅਸੀਂ ਬਣਾ ਵੀ ਸਕਦੇ ਹਾਂ ਪਰ ਕਈ ਵਾਰ ਇਹ ਹੁੰਦਾ ਵੀ ਅਸੀਂ ਉਹਨਾਂ ਦੀ ਅਕੋਰਡਿੰਗ ਉਹਨਾਂ ਦੀਆਂ ਰੈਸਪੀਆਂ ਲੈ ਤਾਂ ਲੈਂਦੇ ਹਾਂ ਪਰ ਉਹਨਾਂ ਵਾਲੀਆਂ ਚੀਜ਼ਾਂ ਸਾਨੂੰ ਇੱਥੇ ਅਵੇਲੇਬਲ ਨਹੀਂ ਹੁੰਦੀਆਂ ਅਤੇ ਉਹ ਚੀਜ਼ ਉੱਦਾਂ ਦੀ ਨਹੀਂ ਬਣ ਪਾਉਂਦੀ ਜਿਵੇਂ ਦੀ ਉਹ ਸਾਨੂੰ ਵੀਡੀਓ ਦੇ ਵਿੱਚ ਸ਼ੋਅ ਕਰ ਰਹੇ ਹੁੰਦੇ ਆ ਹੋ ਸਕਦਾ ਸਾਡੇ ਕੋਲੋਂ ਉਹ ਚੀਜ਼ ਉੱਦਾਂ ਨਹੀਂ ਬਣ ਪਾਉਂਦੀ ਜਾਂ ਕੋਈ ਉੱਥੋਂ ਦੀ ਚੀਜ਼ ਦੀ ਕਮੀ ਆ ਜਾਂਦੀ ਹੈ ਜਾਂ ਕੁਛ ਵੀ ਹੁੰਦਾ ਹੈ ਅਤੇ ਪਰ ਫਿਰ ਵੀ ਅਸੀਂ ਕੁਛ ਕੁਛ ਮਤਲਬ ਜੋ ਅ ਉੱਥੋਂ ਦੇ ਲੋਕਾਂ ਦੇ ਖਾਣੇ ਦਾ ਅਸੀਂ ਟੇਸਟ ਕਰ ਲੈਂਦੇ ਹਾਂ ਪਰ ਕਈ ਵਾਰ ਕੋਈ ਚੀਜ਼ ਇੰਨੀ ਖ਼ਰਾਬ ਹੋ ਜਾਂਦੀ ਹੈ ਕਿ ਬਰਬਾਦ ਵੀ ਕਰਨ ਨੂੰ ਦਿਲ ਨਹੀਂ ਕਰਦਾ ਪਰ ਦਿਲ ਕਰਦਾ ਕਿ ਇਹਨੂੰ ਕਿਸੇ ਤਰ੍ਹਾਂ ਅਸੀਂ ਆਪਣੇ ਵੱਲੋਂ ਕੁਛ ਉਹਦੇ ਵਿੱਚ ਚੇਂਜਿਸ ਕਰ ਲਈਏ ਜਿਹਦੇ ਨਾਲ ਉਹ ਸਾਡੇ ਖਾਣਯੋਗ ਹੋ ਜਾਣ ਕਿਉਂਕਿ ਭੋਜਨ ਨੂੰ ਬਰਬਾਦ ਕਰਨਾ ਵੀ ਅਸੀਂ ਬਹੁਤ ਮਾੜਾ ਮੰਨਦੇ ਹਾਂ ਅਤੇ ਭੋਜਨ ਬਰਬਾਦ ਕਰਨਾ ਚਾਹੀਦਾ ਵੀ ਨਹੀਂ ਹੈ ਇਸ ਕਰਕੇ ਹੁਣ ਮੈਂ ਥੋੜ੍ਹੀ ਦੇਰ ਪਹਿਲਾਂ ਮੈਂ ਵੀ ਇੱਕ ਵਾਰ ਯੂਟੀਊਬ ਤੋਂ ਦੇਖ ਕੇ ਫਰਾਈਡ ਰਾਈਸ ਬਣਾਉਣ ਦੀ ਕੋਸ਼ਿਸ਼ ਕੀਤੀ ਕਿ ਮੈਂ ਕਦੇ ਬਣਾਏ ਨਹੀਂ ਸੀ ਮੈਂ ਸੋਚਿਆ ਚਲੋ ਯੂਟੀਊਬ ਤੋਂ ਦੇਖ ਕੇ ਬਣਾਉਂਦੇ ਹਾਂ ਬਣਾਏ ਵੀ ਉਹਨਾਂ ਵਾਲੀਆਂ ਸਾਰੀਆਂ ਜੋ ਜੋ ਉਹਨਾਂ ਨੇ ਚੀਜ਼ਾਂ ਕਹੀਆਂ ਮਸਾਲੇ ਕਹੇ ਹਰ ਚੀਜ਼ ਮੈਂ ਉਹ ਹੀ ਤਿਆਰ ਕੀਤੀ ਉਸੇ ਤਰ੍ਹਾਂ ਹੀ ਰੱਖੀ ਉਸੇ ਤਰ੍ਹਾਂ ਹੀ ਬਣਾਈ ਪਰ ਫਿਰ ਵੀ ਮੈਨੂੰ ਉਹ ਟੇਸਟ ਨਹੀਂ ਆਇਆ ਜੋ ਕਿ ਅਸੀਂ ਹੋਟਲ ਦੇ ਵਿੱਚ ਖਾਂਦੇ ਹਾਂ ਜਾਂ ਕਿਸੇ ਰੈਸਟੋਰੈਂਟ 'ਚ ਖਾਂਦੇ ਹਾਂ ਅਤੇ ਬਹੁਤ ਸੋਹਣੀ ਬਣੀ ਹੁੰਦੀ ਹੈ ਪਰ ਮੈਨੂੰ ਉਹਦੇ ਵਿੱਚ ਨਾ ਕੋਈ ਕਮੀ ਲੱਗ ਰਹੀ ਸੀ ਹੋ ਸਕਦਾ ਮੈਨੂੰ ਉਹਨਾਂ ਦੇ ਹਿਸਾਬ ਦੀ ਨਮਕ ਮਿਰਚ ਮੈਂ ਨਹੀਂ ਪਾ ਪਾਈ ਜਾਂ ਹੋ ਸਕਦਾ ਕਿ ਮੈਂ ਉਸ ਤਰ੍ਹਾਂ ਦਾ ਤੜਕਾ ਨਹੀਂ ਲਗਾ ਸਕੀ ਜਿਹੜਾ ਕਿ ਉਹਦੇ ਵਿੱਚ ਹੋਣਾ ਚਾਹੀਦਾ ਸੀ ਅਤੇ ਪਰ ਫਿਰ ਵੀ ਮੈਂ ਫਿਰ ਮੈਂ ਸੋਚਿਆ ਕਿ ਇਹਨੂੰ ਸੁੱਟਣ ਦੀ ਬਜਾਏ ਇਹਨੂੰ ਮੈਂ ਕੁਛ ਹੋਰ ਇਹਦੇ ਵਿੱਚੋਂ ਆਪਣੇ ਵੱਲੋਂ ਕੁਛ ਐਡ ਕਰ ਲਵਾਂ ਤਾਂ ਕਿ ਉਹ ਨਾ ਹੋ ਸਕੇ ਖਰ ਬਰਬਾਦ ਨਾ ਹੋ ਸਕੇ ਮੈਂ ਕਿਤੇ ਮੈਨੂੰ ਸੁੱਟਣਾ ਨਾ ਪੈ ਜਾਵੇ ਖਾਣੇ ਨੂੰ ਅਤੇ ਇਸ ਕਰਕੇ ਫਿਰ ਮੈਂ ਉਹਨੂੰ ਟੇਸਟ ਕੀਤਾ ਮੈਨੂੰ ਲੱਗਾ ਕਿ ਜਿਵੇਂ ਇਹਨੂੰ ਆਪਣਾ ਥੋੜ੍ਹਾ ਪੰਜਾਬੀ ਸਟਾਈਲ ਦੇ ਨਾਲ ਜੇ ਮੈਂ ਇਹਨੂੰ ਤੜਕਾ ਲਾ ਦਵਾਂ ਥੋੜ੍ਹੇ ਜਿਹੇ ਵਿੱਚ ਮਸਾਲੇ ਪੰਜਾਬੀ ਮਸਾਲੇ ਪਾ ਦਵਾਂ ਜਾਂ ਥੋੜ੍ਹੀਆਂ ਹੋਰ ਜਿਹੜੀਆਂ ਅੱਜ ਕੱਲ੍ਹ ਦੀਆਂ ਸੋਸਿਸ ਬੜੀ ਤਰ੍ਹਾਂ ਦੀਆਂ ਆ ਗਈਆਂ ਉਹ ਪਾ ਦਵਾਂ ਤਾਂ ਸ਼ਾਇਦ ਉਹਨਾਂ ਦੇ ਨਾਲ ਠੀਕ ਹੋ ਜਾਵੇ ਫਿਰ ਮੈਂ ਉਹਨੂੰ ਇਸ ਤਰ੍ਹਾਂ ਹੀ ਕੀਤਾ ਪਹਿਲਾਂ ਤਾਂ ਮੈਂ ਫਰਾਈਡ ਰਾਈਸ ਉਹਨਾਂ ਦੇ ਹਿਸਾਬ ਨਾਲ ਵੀ ਬਣਾ ਲਏ ਸੀ ਯੂਟੀਊਬ ਦੇ ਹਿਸਾਬ ਨਾਲ ਫਿਰ ਮੈਂ ਉਹਨੂੰ ਬਾਅਦ ਵਿੱਚ ਆਪਣੇ ਪੰਜਾਬੀ ਸਟਾਈਲ ਨਾਲ ਘਿਓ ਪਾ ਕੇ ਵਿੱਚ ਜ਼ੀਰਾ ਵਗੈਰਾ ਪਾ ਕੇ ਉਹਦਾ ਮੈਂ ਤੜਕਾ ਅਲੱਗ ਲਾਇਆ ਵਿੱਚ ਸੋਇਆ ਸੋਸ ਥੋੜ੍ਹੀ ਜਿਹੀ ਪਾ ਲਈ ਅਤੇ ਉਹਦੇ ਨਾਲ ਮੈਨੂੰ ਬਹੁਤ ਜ਼ਿਆਦਾ ਹੀ ਟੇਸਟੀ ਲੱਗਾ ਮੈਨੂੰ ਲੱਗਾ ਕਿ ਇਹ ਇੱਕ ਰੈਸਪੀ ਅਲੱਗ ਦੇ ਦੇਣੀ ਚਾਹੀਦੀ ਹੈ ਕਿ ਆਪਾਂ ਫਰਾਈਡ ਰਾਈਸ ਤਿਆਰ ਕਰੀਏ ਬਾਅਦ 'ਚ ਇਹ ਚੀਜ਼ਾਂ ਐਡੀਸ਼ਨ ਕਰਵਾਈਏ ਤਾਂ ਹੋਰ ਜ਼ਿਆਦਾ ਟੇਸਟੀ ਬਣ ਜਾਂਦੀਆਂ ਨੇ ਔਰ ਉਹਨੂੰ ਸਾਰਿਆਂ ਨੇ ਘਰ ਦੇ ਵਿੱਚ ਵੀ ਸਾਰਿਆਂ ਨੇ ਬਹੁਤ ਜ਼ਿਆਦਾ ਪਸੰਦ ਕੀਤਾ